ਪੇਂਡੂ ਅਤੇ ਸ਼ਹਿਰੀ ਖੇਤਰਾਂ ਨੂੰ ਹਸਪਤਾਲਾਂ ਦੀ ਬਹੁਤ ਸ ਲੋੜ ਹੈ ਇੱਥੇ ਬਿਮਾਰੀਆਂ ਇਸ ਕਰਕੇ ਵੱਧਦੀਆਂ ਹਨ ਕਿਉਂਕਿ ਕਿ ਇੱਥੇ ਥੋੜ੍ਹੀ ਜਿਹੀ ਸਹੂਲਤ ਘੱਟ ਹੈ ਪ ਟੋਬਿਆਂ ਕਾਰਨ ਬਿਮਾਰੀਆਂ ਫੈਲ ਜਾਂਦੀਆਂ ਹਨ ਸ਼ ਸਫਾਈ ਕਾਰਨ ਬਿਮਾਰੀਆਂ ਫੈਲ ਜਾਂਦੀਆਂ ਹਨ ਇਸ ਲਈ ਇੱਥੇ ਥੋੜ੍ਹੀ ਜਿਹੀ ਪਰ ਦਿੱਕਤ ਆਉਂਦੀ ਹੈ ਅਤੇ ਇੱਥੇ ਕਈ ਬਿਮਾਰੀਆਂ ਤੁਰੇ ਜਾਂਦੇ ਬੰਦਿਆਂ ਨੂੰ ਹੀ ਚਿਮੜ ਜਾਂਦੀਆਂ ਹਨ ਸਾਡੇ ਹਸਪਤਾਲ ਦੇ ਵਿੱਚ ਜੇ ਡਾਕਟਰ ਹਨ ਤਾਂ ਦਵਾਈਆਂ ਨਹੀਂ ਮਿਲਦੀਆਂ ਜੇ ਦਵਾਈਆਂ ਹੈਗੀਆਂ ਤਾਂ ਡਾਕਟਰ ਨਹੀਂ ਹੈਗੇ ਤਾਂ ਇਸ ਲਈ ਇਹ ਇਹਨਾਂ ਦਾ ਬਹੁਤ ਜ਼ਰੂਰੀ ਹੈ ਪ੍ਰਸ਼ਾਸਨ ਹੈ ਅਤੇ ਇਹਨਾਂ ਵਿੱਚ ਸਾਨੂੰ ਦਵਾਈਆਂ ਜਾਂ ਪਿੰਡਾਂ ਸ਼ ਪਿੰਡਾਂ ਦੇ ਵਿੱਚ ਰਹਿਣ ਲਈ ਕੋਈ ਕੋਈ ਬਿਮਾਰੀਆਂ ਦਾ ਹੱਲ ਨਹੀਂ ਨਿਕਲਦਾ ਇਸ ਕਰਕੇ ਅਸੀਂ ਬਿਮਾਰੀਆਂ ਨਾਲ ਲੜ ਰਹੇ ਹਾਂ ਅਤੇ ਸ਼ਹਿਰ ਵਿੱਚ ਜਾ ਕੇ ਦੋ